ਬਦਲਦੇ ਮੌਸਮ ਦਾ ਕਿਸਾਨਾਂ ਦੀ ਖੇਤੀ 'ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਬਦਲਦੇ ਮੌਸਮ ਕਾਰਨ ਖੇਤੀ ਵਿੱਚ ਜਿਵੇਂ ਹੜ੍ਹ ਸੋਕਾ ਸਰਦੀਆਂ ਚੱਕਰਵਾਤੀ ਤੂਫਾਨ ਗੜ੍ਹੇ ਆਦਿ ਆਉਂਦੇ ਹਨ ਇਸ ਨਾਲ ਕਿਸਾਨ ਨੂੰ ਕਾਫੀ ਰੁਕਾਵਟਾਂ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਸੋਕਾ ਪੈਣ ਨਾਲ ਪਾਣੀ ਦੀ ਮਾਤਰਾ ਘੱਟ ਜਾਂਦੀ ਹੈ ਅਤੇ ਕਿਸਾਨਾਂ ਨੂੰ ਉੱਚਿਤ ਵਰਤੋਂ ਵਿੱਚ ਸਿੰਜਾਈ ਕਰਨ ਲਈ ਪਾਣੀ ਦੀ ਘਾਟ ਮਹਿਸੂਸ ਹੁੰਦੀ ਹੈ ਅਤੇ ਸੋਕਾ ਹੜ੍ਹ ਹੜ੍ਹ ਆਉਣ ਨਾਲ ਜਿਵੇਂ ਵਧੇਰੇ ਵਰਖਾ ਦਾ ਪੈ ਜਾਣਾ ਬਣੀ ਬਣਾਈ ਫਸਲ ਨੂੰ ਪਾਣੀ ਵਿੱਚ ਵਹਿਣ ਜ਼ਿਆਦਾ ਹੋਣ ਕਾਰਨ ਪਾਣੀ ਫਸਲਾਂ ਨੂੰ ਵਹਾ ਕੇ ਲੈ ਜਾਂਦੀ ਹੈ ਅਤੇ ਬਣੀਆਂ ਬਣਾਈਆਂ ਫਸਲਾਂ ਨੂੰ ਮਾਰਾਮਾਰੀ ਕਰ ਦਿੰਦੀ ਹੈ ਇਸ ਦਾ ਵੀ ਕਿਸਾਨਾਂ ਨੂੰ ਕਾਫੀ ਨੁਕਸਾਨ ਹੁੰਦਾ ਹੈ ਚੱਕਰਵਾਤ ਤੂਫਾਨ ਚੱਕਰਵਾਤ ਤੂਫਾਨ ਤੋਂ ਇਲਾਵਾ ਬਹੁਤ ਜ਼ਿਆਦਾ ਹਨੇਰੀਆਂ ਦਾ ਚੱਲਣਾ ਪੱਕੀ ਪਕਾਈ ਫਸਲ ਨੂੰ ਜ਼ਿਆਦਾ ਹਨੇਰੀ ਆਉਣ ਕਰਕੇ ਡਿੱਗ ਜਾਂਦੀਆਂ ਹਨ ਅਤੇ ਬਿਲਕੁਲ ਖਰਾਬ ਹੋ ਜਾਂਦੀਆਂ ਹਨ ਇਸ ਕਰਕੇ ਬਦਲਦੇ ਮੌਸਮ ਖੇਤੀਬਾੜੀ ਲਈ ਨੁਕਸਾਨਦਾਇਕ ਸਿੱਧ ਹੁੰਦੇ ਹਨ ਗੜ੍ਹੇ ਜ਼ਿਆਦਾ ਬਾਰਿਸ਼ ਹੋਣ ਕਾਰਨ ਜਾਂ ਜ਼ਿਆਦਾ ਗੜ੍ਹਿਆਂ ਦੀ ਮਾਤਰਾ ਹੋਣ ਕਰਕੇ ਫਸਲਾਂ ਬਿਲਕੁਲ ਨੁਕਸਾਨੀਆਂ ਜਾਂਦੀਆਂ ਹਨ ਅਤੇ ਇਸ ਨਾਲ ਕਿਸਾਨ ਨੂੰ ਕਾਫੀ ਨੁਕਸਾਨ ਹੁੰਦਾ ਹੈ ਅਤੇ ਸਭ ਤੋਂ ਵੱਧ ਮਾਰ ਕਿਸਾਨ ਨੂੰ ਹੀ ਪੈਂਦੀ ਹੈ